ਸਤਿ ਸ਼੍ਰੀ ਅਕਾਲ ਮੈਂ ਪ੍ਰਿਆ ਜਿਵੇਂ ਕਿ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਦਿਲਚਸਪ ਅਤੇ ਅਧਾ ਅਸਧਾਰਨ ਸ਼ਬਦ ਜਾਂ ਵਾਕੰਸ਼ ਹਨ ਜਿਵੇਂ ਕਿ ਨਤਮਸਤਕ ਜੀ ਆਇਆਂ ਨੂੰ ਨਤਮਸਤਕ ਸ਼ਬਦ ਜੋ ਹੈ ਉਹ ਉਦੋਂ ਉ ਇਸਤੇਮਾਲ ਵਿੱਚ ਲਿਆਇਆ ਜਾਂਦਾ ਹੈ ਜਦੋਂ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ ਅ ਜ਼ਿਆਦਾਤਰ ਅਸੀਂ ਗੁਰਦੁਆਰੇ ਵਿੱਚ ਕਿਸੇ ਧਾਰਮਿਕ ਸਥਾਨਾਂ 'ਤੇ ਜਾਂ ਆਪਣੇ ਵੱਡੇ ਵਡੇਰਿਆਂ ਆ ਗਏ ਜਦੋਂ ਸ਼ੁ ਸਿਰ ਨੂੰ ਝੁਕਾਉਂਦੇ ਹਾਂ ਤਾਂ ਉਸ ਨੂੰ ਕਹਿੰਦੇ ਹਨ ਨਤਮਤਸਕ ਹੋਣਾ ਅਤੇ ਜੀ ਆਇਆਂ ਨੂੰ ਇਹ ਪੰਜਾਬੀਆਂ ਦਾ ਇੱਕ ਅਜਿਹਾ ਸ਼ਬਦ ਹੈ ਜਦੋਂ ਕਿਸੇ ਨੂੰ ਅਸੀਂ ਆਪਣੇ ਘਰ ਬੁਲਾਉਂਦੇ ਹਾਂ ਆਓ ਭਗਤ ਲਈ ਬੈਠਣ ਲਈ ਕਹਿੰਦੇ ਹਾਂ ਤਾਂ ਅਸੀਂ ਜੀ ਆਇਆਂ ਸ਼ਬਦਾਂ ਦਾ ਵਰਤੋਂ ਕਰਦੇ ਹਾਂ ਪੰਜਾਬੀ ਵਿੱਚ ਹੋਰ ਵੀ ਕਈ ਵਾਕੰਸ਼ ਹਨ ਜਿਵੇਂ ਸਰਦਾਰਨੀ ਫੁੱਟਪਾਥ ਬਚਪਨ ਦੀ ਵਾਰ ਬਹੁਤ ਸ਼ੱਕ ਛਾਪਿਆ ਆਦਿ ਧੰਨਵਾਦ ਜੀ